ਅੱਜ ਦਾ ਯੁੱਗ ਸ਼ੋਸ਼ਲ ਮੀਡੀਆ ਦਾ ਯੁੱਗ ਹੈ ਜਿਸ ਦੇ ਵਿੱਚ ਇੰਸਟਾਗ੍ਰਾਮ ਫੇਸਬੁੱਕ ਅਤੇ ਯੂਟਿਊਬ ਇਨ੍ਹਾਂ ਦੇ ਰਾਹੀਂ ਲੋਕਾਂ ਨੂੰ ਸਮਾਜ ਦੇ ਨਾਲ ਜੋੜਿਆ ਜਾਂਦਾ ਹੈ ਸੰਗੀਤ ਅਤੇ ਡਾਂਸ ਜ਼ਿੰਦਗੀ ਦਾ ਇੱਕ ਅਨਮੋਲ ਹਿੱਸਾ ਹਨ ਡਾਂਸ ਦੇ ਦੁਆਰਾ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਵਿਚਾਰਾਂ ਨੂੰ ਪ੍ਰਗਟ ਕਰ ਸਕਦੇ ਹਾਂ ਆਪਣੀਆਂ ਸਾਰੀਆਂ ਮਾਨਸਿਕ ਚਿੰਤਾਵਾਂ ਨੂੰ ਦੂਰ ਕਰਕੇ ਅਨੰਦ ਦਾ ਅਹਿਸਾਸ ਕਰ ਸਕਦੇ ਹਾਂ ਡਾਂਸ ਇੱਕ ਇਸ ਤਰ੍ਹਾਂ ਦੀ ਕਿਰਿਆ ਹੈ ਜਿਸ ਦੇ ਵਿੱਚ ਸਰੀਰਕ ਐਕਟੀਵੀਟੀਸ ਤਾਂ ਹੁੰਦੀਆਂ ਹੀ ਹਨ ਪਰ ਇਸਦੇ ਨਾਲ ਮਨ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਮਿਲਦੀ ਹੈ ਇਸ ਲਈ ਹਰ ਇੱਕ ਬੰਦੇ ਨੂੰ ਆਪਣੀਆਂ ਇਸ ਟੈਂਸ਼ਨਾਂ ਭਰੀ ਜ਼ਿੰਦਗੀ ਦੇ ਵਿੱਚ ਅਨੰਦ ਮਾਣਨ ਦੇ ਲਈ ਹਮੇਸ਼ਾ ਸੰਗੀਤ ਅਤੇ ਡਾਂਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਟੀ ਵੀ ਦੇ ਉੱਤੇ ਵੀ ਬਹੁਤ ਸਾਰੇ ਸ਼ੋਅ ਚਲਾਏ ਜਾਂਦੇ ਹਨ ਜਿਵੇਂ ਕਿ ਡਾਂਸ ਇੰਡੀਆ ਡਾਂਸ ਨੱਚ ਬੱਲੀਏ ਇਨ੍ਹਾਂ ਦੇ ਵਿੱਚ ਬੰਦਿਆਂ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਨੱਚਣ ਦਾ ਡਾਂਸ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਸਦੇ ਵਿੱਚ ਲੋਕ ਨਾਚ ਵੀ ਜਿਹੜੇ ਨੇ ਉਹ ਦਿਖਾਏ ਜਾਂਦੇ ਨੇ ਇਨ੍ਹਾਂ ਦੇ ਦੁਆਰਾ ਬੱਚਿਆਂ ਦੇ ਵਿੱਚ ਡਾਂਸ ਦੇ ਵਿੱਚ ਰੁਚੀ ਪੈਦਾ ਹੁੰਦੀ ਹੈ ਉਨ੍ਹਾਂ ਨੂੰ ਇੱਕ ਪਲੇਟਫੋਮ ਮਿਲਦਾ ਹੈ ਜਿਸ ਦੇ ਨਾਲ ਉਹ ਆਪਣੀ ਪ੍ਰਤਿਭਾ ਆਪਣੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਦੇ ਨੇ ਉਹ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦੇ ਨੇ ਇਸ ਤਰੀਕੇ ਨਾਲ ਉਹ ਡਾਂਸ ਦੇ ਦੁਆਰਾ ਆਪਣੇ ਇੱਕ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਦੇ ਹਨ ਇਸ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਕੂਨ ਵੀ ਪ੍ਰਾਪਤ ਹੁੰਦਾ ਹੈ ਅਤੇ ਕਈ ਲੋਕਾਂ ਦੇ ਲਈ ਇਹ ਰੁਜ਼ਗਾਰ ਦਾ ਸਾਧਨ ਵੀ ਬਣ ਜਾਂਦਾ ਹੈ ਇਸ ਲਈ ਹਰ ਇੱਕ ਇਨਸਾਨ ਨੂੰ ਆਪਣੀਆਂ ਜ਼ਰੂਰੀ ਦੈਨਿਕ ਕਿਰਿਆਵਾਂ ਦੇ ਨਾਲ ਸੰਗੀਤ ਅਤੇ ਡਾਂਸ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਵੀ ਇਸਦੀ ਬਹੁਤ ਜ਼ਰੂਰਤ ਹੈ